ਸਤਿ ਸ਼੍ਰੀ ਅਕਾਲ ਹਾਂਜੀ ਹਾਂ ਬਿਲਕੁਲ ਦੱਸੋ ਹਾਂ ਬਿਲਕੁਲ ਸਰ ਇੰਨੀ ਵੱਡੀ ਗੱਲ ਹੋਈ ਹੈ ਕਿਵੇਂ ਭੁੱਲ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਗੱਲ ਦਰਅਸਲ ਇਹ ਹੋਈ ਕਿ ਪੰਜਾਬ ਦੇ ਵਿੱਚ ਤਾਂ ਮੀਂਹ ਨਹੀਂ ਪਿਆ ਜਿੰਨਾ ਪੈਣਾ ਚਾਹੀਦਾ ਸੀਗਾ ਪਰ ਜਿਵੇਂ ਕਿ ਪੰਜਾਬ ਦੇ ਆਸ ਪਾਸ ਦੇ ਜਿਹੜੇ ਇਲਾਕੇ ਨੇ ਜਿਵੇਂ ਪਹਾੜੀ ਇਲਾਕੇ ਨੇ ਜਿਵੇਂ ਉੱਤਰਾਖੰਡ ਹੈ ਠੀਕ ਹੈ ਹਿਮਾਚਲ ਹੈ ਇਹਨਾਂ ਵਿੱਚ ਮਾਤਰਾ ਤੋਂ ਜ਼ਿਆਦਾ ਮੀਂਹ ਪੈ ਗਿਆ ਜਿੰਨਾ ਮਤਲਬ ਕਿ ਪੈਣਾ ਚਾਹੀਦਾ ਸੀ ਉਸ ਤੋਂ ਜ਼ਿਆਦਾ ਮੀਂਹ ਪੈ ਗਿਆ ਉਹਦੇ ਕਰਕੇ ਗੱਲ ਇਹ ਬਣੀ ਕਿ ਉਥੇ ਜੋ ਡੈਮ ਸੀਗੇ ਉਹਨਾਂ ਦੀ ਕਪੈਸਿਟੀ ਹੈ ਨਹੀਂ ਸੀਗੀ ਪਾਣੀ ਰੋਕਣ ਦੀ ਮੀਂਹ ਕਰਕੇ

ਡੈਮ ਵਿੱਚ ਜੇ ਇਹਨਾਂ ਦੇ ਟਾਈਮ ਤੱਕ ਜੇ ਗੱਲ ਇਹ ਨਾ ਕਿ ਡੈਮ ਦੀ ਇੰਨੀ ਕਪੈਸਿਟੀ ਹੈ ਨਹੀਂ ਸੀਗੀ ਡੈਮ ਹੈਗੇ ਨੇ ਛੋਟੇ ਤੇ ਜ਼ਿਆਦਾ ਟਾਈਮ ਤਾਂ ਕੋਈ ਪਾਣੀ ਸੰਭਾਲ ਕੇ ਰੱਖਦੇ ਤਾਂ ਡੈਮ ਟੁੱਟ ਜਾਣੇ ਸੀਗੇ ਅਤੇ ਉਹ ਡੈਮ ਟੁੱਟ ਜਾਂਦੇ ਤਾਂ ਜੋ ਹੁਣ ਇਸ ਟਾਈਮ 'ਤੇ ਜੋ ਤਬਾਹੀ ਹੋਈ ਹਾਂਜੀ ਹਾਂਜੀ ਬਿਲਕੁਲ ਉਹੀ ਗੱਲ ਮੈਂ ਦੱਸ ਰਿਹਾ ਕਿ ਜ਼ਿਆਦਾ ਤਬਾਹੀ ਹੋ ਜਾਣੀ ਸੀ ਪੰਜਾਬ ਦੇ ਵਿੱਚ ਤਾਂ ਕਰਕੇ ਪਾਣੀ ਖੋਲ੍ਹਣਾ ਪਿਆ ਸਾਨੂੰ ਸਾਡੀ ਵੀ ਮਜਬੂਰੀ ਸੀ ਇਸ ਚੀਜ਼ ਦੀ ਹੋਰ ਕੋਈ ਗੱਲ ਨਹੀਂ ਨਹੀਂ ਤਾਂ ਅਸੀਂ ਕਿਉਂ ਚਾਵਾਂਗੇ ਮਤਲਬ ਕਿ ਇਸ ਤਰ੍ਹਾਂ ਦਾ ਕੁਛ ਵੀ ਹੋਵੇ ਉੱਚਾ ਨੀਵਾਂ ਕੰਮ ਹੋਵੇ

ਸੱਚਾਈ ਤਾਂ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਾਫੀ ਸਮਝਾਇਆ ਵੀ ਗਿਆ ਹੈ ਠੀਕ ਹੈ ਪਰ ਉਹ ਹੈ ਕਿ ਉਹ ਗੱਲ ਮੰਨਦੇ ਨਹੀਂ ਹੈਗੇ ਉਹੀ ਇੱਕ ਹੀ ਫਸਲ ਨੂੰ ਵਾਰ ਵਾਰ ਘੁੰਮਾਈ ਜਾਂਦੇ ਨੇ ਉਹੀ ਚੀਜ਼ ਮੈਂ ਦੱਸ ਰਿਹਾ ਨਾ ਕਿ ਕਿਸਾਨਾਂ ਨੂੰ ਬਹੁਤ ਵਾਰ ਸਮਝਾਇਆ ਕਿ ਤੁਸੀਂ ਇੱਕ ਹੀ ਫਸਲ ਨੂੰ ਵਾਰ ਵਾਰ ਨਾ ਲਾਓ ਜਿਵੇਂ ਕਿ ਝੋਨਾ ਹੈ ਉਹ ਹਰ ਸਾਲ ਲੱਗਦਾ ਅਤੇ ਉਹਨਾਂ ਨੂੰ ਇਹ ਵੀ ਪਤਾ ਕਿ ਝੋਨੇ 'ਤੇ ਪਾਣੀ ਬਹੁਤ ਜ਼ਿਆਦਾ ਲੱਗ ਜਾਂਦਾ ਜ਼ਿਆਦਾ ਪਾਣੀ ਮੰਗਦੀ ਉਹ ਫਸਲ ਤਾਂ ਕਰਕੇ ਉਹਨਾਂ ਨੂੰ ਇਹ ਚੀਜ਼ ਸਮਝਾਈ ਹੈ ਕਿ ਜਿਹੜਾ ਬਾਰਿਸ਼ ਦਾ ਪਾਣੀ ਆ ਉਹਨੂੰ ਉਹਦੀ ਸੰਭਾਲ ਕਰੋ ਉਹਨੂੰ ਵਰਤੋ ਦੇ ਵਿੱਚ ਲਿਆਓ ਜ਼ਮੀਨ ਦਾ ਪਾਣੀ ਉਹਨੂੰ ਘੱਟੋ ਘੱਟ ਉਸਦੀ ਵਰਤੋਂ ਕਰੋ ਤਾਂ ਕਿ ਤੁਹਾਨੂੰ ਜੇ ਹੋ ਸਕੇ ਕਿ ਅਗਲੇ ਸਾਲ ਜੇ ਕਦੇ ਵੀ ਜੇ ਬਾਰਿਸ਼ ਨਹੀਂ ਹੁੰਦੀ ਤਾਂ ਤੁਸੀਂ ਅੱਗੇ ਜਾ ਕੇ ਉਹ ਜ਼ਮੀਨ ਦਾ ਪਾਣੀ ਵਰਤੋਂ ਵਿੱਚ ਲੈ ਸਕਦੇ ਹੋ ਤਾਂ ਤੁਸੀਂ ਇਹੋ ਜਿਹੀਆਂ ਫਸਲਾਂ ਵੀ ਲਗਾਓ ਕਿ ਜੋ ਕਿ ਪਾਣੀ ਘੱਟ ਮੰਗਣ ਬੈਨੀਫਿਟ ਦਾ ਤਾਂ ਇਹੀ ਹੈ ਕਿ ਜਿੰਨਾ ਵੀ ਆਪਾਂ ਕੋਸ਼ਿਸ਼ ਕਰਦੇ ਜਾਵਾਂਗੇ ਕਿ ਆਪਣੀ ਇਹੀ ਕੋਸ਼ਿਸ਼ ਰਹੇਗੀ ਕਿ ਆਪਾਂ ਸਮਝਾਈਏ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਇਹ ਚੀਜ਼ ਸਮਝਾਈਏ ਤਾਂਕਿ ਅੱਗੇ ਜਾ ਕੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਤਕਲੀਫ਼ ਨਾ ਆਵੇ ਕਿਉਂਕਿ ਤੁਹਾਨੂੰ ਪਤਾ ਕਿ ਜੇ ਕਿਸਾਨ ਹੀ ਮਤਲਬ ਕਿ ਜੇ ਨਹੀਂ ਫਸਲ ਉਗਾ ਪਾਣਗੇ ਤਾਂ ਪੂਰੇ ਦੇਸ਼ 'ਤੇ ਇਸ ਚੀਜ਼ ਦਾ ਪ੍ਰਭਾਵ ਪਏਗਾ ਠੀਕ ਹੈ ਬਾਕੀ ਤੁਹਾਨੂੰ ਜੇ ਹੋਰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਜ਼ਰੂਰਤ ਹੋਈ ਤਾਂ ਤੁਸੀਂ ਮੈਨੂੰ ਬੇਸ਼ਕ ਫੋਨ ਕਰਿਓ ਮੈਂ ਤੁਹਾਡੀ ਪੂਰੀ ਮਦਦ ਕਰਾਂਗਾ ਠੀਕ ਆ ਓਕੇ ਸਰ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਜੀ